ਮੇਰਾ ਜਿਹੜਾ ਜੱਦੀ ਸ਼ਹਿਰ ਹੈ ਉਹ ਰੋਪੜ ਸ਼ਹਿਰ ਹੈ ਮੈਨੂੰ ਇੱਥੇ ਦੀਆਂ ਜਿਹੜੀਆਂ ਚੀਜ਼ਾਂ ਬਹੁਤ ਪਸੰਦ ਨੇ ਜਿੱਦਾਂ ਕਿ ਹੈੱਡਵਰਕਸ ਹੋ ਗਿਆ ਵੇਰਕਾ ਮਿਲਕ ਪਲਾਂਟ ਹੋ ਗਿਆ ਅਤੇ ਇੱਥੋਂ ਦੇ ਗੁਰਦੁਆਰਾ ਸਾਹਿਬ ਭੱਠਾ ਸਾਹਿਬ ਟਿੱਬੀ ਸਾਬ ਸਾਹਿਬ ਇੱਥੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਨੇ ਅਤੇ ਅਸੀਂ ਉੱਥੇ ਜਾ ਕੇ ਮੱਥਾ ਟੇਕਣ ਦੇ ਵਿੱਚ ਮੱਥਾ ਟੇਕ ਕੇ ਆਪਣੇ ਮਨ ਦੀਆਂ ਅਰਦਾਸਾਂ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ